ਮੈਂ ਸੋਚਦਾ ਹਾਂ ਕਿ ਚਿੱਤਰਕਾਰੀ ਹਰ ਕਿਸੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅੱਜ ਦੀ ਭੱਜ ਨੱਠ ਦੀ ਜ਼ਿੰਦਗੀ ਹੀ ਐਵੇਂ ਦੀ ਹੈ ਕਿਉਂਕਿ ਹਰ ਇੱਕ ਬੰਦਾ ਅਸ਼ਾਂਤ ਹੈ ਉਸ ਦੇ ਸ਼ਾਂਤੀ ਦੇ ਲਈ ਕੋਈ ਵੀ ਬੰਦਾ ਆਪਣੀ ਚਿੱਤਰਕਾਰੀ ਰਾਹੀਂ ਆਪਣੇ ਮਨੋਭਾਵਾਂ ਨੂੰ ਵਿਅਕਤ ਕਰ ਸਕਦਾ ਹੈ ਜਿਵੇਂ ਕਿ ਜਿਵੇਂ ਹੀ ਇੱਕ ਬੰਦਾ ਇਕ ਪੈਂਸਿਲ ਚੱਕਦਾ ਹੈ ਤਾਂ ਉਹ ਆਪਣੇ ਜੋ ਮਨ ਦੀ ਰਚਨਾਤਮਕਤਾ ਹੁੰਦੀ ਹੈ ਉਹ ਆਪਣੇ ਆਪ ਇੱਕ ਪੇਜ਼ 'ਤੇ ਉਕੇਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇੱਕ ਵਧੀਆ ਤਰੀਕੇ ਨਾਲ ਇੱਕ ਬਹੁਤ ਵਧੀਆ ਚਿੱਤਰਕਾਰੀ ਕਰਦਾ ਹੈ ਇਸ ਦੇ ਰਾਹੀਂ ਆਪਾਂ ਅਨੁਸ਼ਾਸਨ ਵੀ ਸਿੱਖਦੇ ਹਾਂ ਜਿਵੇਂ ਜਿੱ ਕਿਸੇ ਕੋਈ ਤਸਵੀਰ ਬਣਾਈਏ ਤਾਂ ਉਸ 'ਚ ਉਵੇਂ ਦਾ ਹੀ ਰੰਗ ਭਰਿਆ ਜਾਂਦਾ ਹੈ ਅਤੇ ਉੱਥੋਂ ਤੱਕ ਹੀ ਰੰਗ ਭਰਿਆ ਜਾਂਦਾ ਹੈ ਜਿੱਥੋਂ ਤੱਕ ਕਿ ਜਾਇਜ ਹੁੰਦਾ ਹੈ ਚਿੱਤਰਕਾਰੀ ਹੀ ਸਾਨੂੰ ਸੰਗ ਇੱਕ ਸੰਗਠਨਾਤਮਕ ਤਰੀਕੇ ਨਾਲ ਰਹਿਣਾ ਸਿਖਾਉਂਦੀ ਹੈ ਜਿਵੇਂ ਕਿ ਇੱਕ ਰੰਗ ਦੂਜੇ ਰੰਗ ਵਿੱਚ ਮਿਲਾ ਕੇ ਬਹੁਤ ਵਧੀਆ ਰੰਗ ਅਤੇ ਗੂੜਾ ਰੰਗ ਬਣਦਾ ਹੈ ਚਿੱਤਰਕਾਰੀ ਰਾਹੀਂ ਸਾਨੂੰ ਹੁਨਰ ਦਾ ਪਤਾ ਲੱਗਦਾ ਹੈ ਅਤੇ ਇੱਕ ਏ ਬੰਦਾ ਇੱਕ ਇੱਕ ਚਿੱਤਰਕਾਰ ਬੰਦਾ ਬਹੁਤ ਹੀ ਜ਼ਿਆਦਾ ਕਲਪਨਾਵਾਦੀ ਹੋ ਸਕਦਾ ਹੈ ਅਤੇ ਬਹੁਤ ਹੀ ਚੰਗੀ ਕਲਪਨਾ ਕਰ ਸਕਦਾ ਹੈ ਅਤੇ ਬਹੁਤ ਹੀ ਵਧੀਆ ਰਚਨਾਕਾਰ ਬਣ ਸਕਦਾ ਹੈ